ਅੱਜ ਕੱਲ੍ਹ ਲੋਕ ਵਾਤਾਵਰਨ ਬਹੁਤ ਹੀ ਖਰਾਬ ਕਰਦੇ ਹਨ ਕਈ ਲੋਕ ਪਰਾਲੀਆਂ ਨੂੰ ਅੱਗ ਲਾਉਂਦੇ ਹਨ ਅਤੇ ਧੂੰਆਂ ਕਰਕੇ ਵਾਤਾਵਰਨ ਖਰਾਬ ਕਰਦੇ ਹਨ ਅਤੇ ਨਦੀਆਂ ਵਿੱਚ ਗੰਦਾ ਪਾਣੀ ਸੁੱਟ ਕੇ ਉਹਨਾਂ ਨੂੰ ਪਾਣੀ ਨੂੰ ਖਰਾਬ ਕਰਦੇ ਹਨ ਅਤੇ ਜੰਗਲਾਂ ਵਿੱਚ ਵੀ ਪਹਾੜੀਆਂ 'ਤੇ ਅੱਗ ਲਾ ਕੇ ਲੋਕ ਪ੍ਰਦੂਸ਼ਣ ਪ੍ਰਦੂਸ਼ਣ ਪ੍ਰਦੂਸ਼ਣ ਕਰਦੇ ਹਨ ਅਤੇ ਖੇਤ ਮਿੱਟੀ ਵਿੱਚ ਮ ਮਿੱਟੀ ਦੇ ਵਿੱਚ ਦਵਾਈਆਂ ਪਾ ਕੇ ਖੇਤ ਦੀ ਮਿੱਟੀ ਵੀ ਖਰਾਬ ਕਰਦੇ ਹਨ ਤਾਂ ਜ ਅਤੇ ਮੌਸਮ ਦੇ ਅਨੁਸਾਰ ਬਰਸਾਤ ਦੇ ਵਿੱਚ ਲੋਕ ਸਫਾਈ ਨਹੀਂ ਕਰਦੇ ਗੰਦਿਆਂ ਨਾਲਿਆਂ ਦੀ ਇਸ ਕਰਕੇ ਬਹੁਤ ਹੀ ਪ੍ਰਦੂਸ਼ਣ ਹੁੰਦਾ ਹੈ ਅਤੇ